ਪੰਦਰ੍ਹਾਂ ਅਗਸਤ ਉੱਨੀ ਸੌ ਵੀਹ ਦੋ ਦਸੰਬਰ ਦੋ ਹਜ਼ਾਰ ਚਾਰ ਪੰਜ ਮਾਰਚ ਉੱਨੀ ਸੌ ਸੱਤਰ ਵੀਹ ਜਨਵਰੀ ਦੋ ਹਜ਼ਾਰ ਦੋ ਸੱਤ ਨਵੰਬਰ ਦੋ ਹਜ਼ਾਰ ਨੌ